ਮੈਂ ਆਪਣੇ ਭਾਰਤ ਨੂੰ ਦਿਖਾਉਣ ਲਈ ਇੱਥੋਂ ਦੀਆਂ ਫੇਮਸ ਜਗ੍ਹਾਵਾਂ ਜਿੱਥੇ ਲੋਕ ਦੂਰੋਂ ਦੂਰੋਂ ਵੇਖਣ ਲਈ ਆਉਂਦੇ ਹਨ ਉਹਨਾਂ ਦੀ ਫੋਟੋ ਕ ਲਵਾਂਗੀ ਜਿਵੇਂ ਕਿ ਤਾਜ ਮਹਿਲ ਅੰਮ੍ਰਿਤਸਰ ਅ ਜੈ ਜੈਪੁਰ ਪੁਰਾਣੇ ਮਹਿਲ ਜਿੱਥੇ ਕਿ ਪੁਰਾਣੇ ਰਾਜੇ ਰਾਣੀਆਂ ਰਹਿੰਦੇ ਸਨ ਚੰਡੀਗੜ੍ਹ ਜਿਹੜਾ ਕਿ ਆਪਣੀ ਅਲੱਗ ਹੀ ਖੂਬਸੂਰਤੀ ਲਈ ਫੇਮਸ ਹੈ ਇੱਥੋਂ ਦੇ ਧਾਰਮਿਕ ਸਥਾਨ ਅਤੇ ਸਭ ਤੋਂ ਵੱਡੀ ਦਰਗਾਹ ਅਜਮੇਰ ਸ਼ਰੀਫ ਜਿੱਥੇ ਲੋਕ ਆਪਣੀਆਂ ਮੰਨਾਂ ਮੰਨਤਾਂ ਪੂਰੀਆਂ ਕਰਨ ਲਈ ਮੱਥਾ ਟੇਕਣ ਜਾਂਦੇ ਹਨ ਇਹ ਜਿਹੀਆਂ ਜਗ੍ਹਾਵਾਂ ਇਹ ਸਾਰੀਆਂ ਜਗ੍ਹਾਵਾਂ ਜੋ ਕਿ ਮੇਰੇ ਭਾਰਤ ਨੂੰ ਦਰਸਾਉਂਦੀਆਂ ਹਨ ਇੱਥੋਂ ਦੇ ਕਲਚਰ ਇੱਥੋਂ ਦੀ ਜਿੰਨੀਆਂ ਵੀ ਸੱਭਿਆਚਾਰਕ ਚੀਜ਼ਾਂ ਨੇ ਇੱਥੋਂ ਦੇ ਲੋਕਾਂ ਦਾ ਰਹਿਣ ਸਹਿਣ ਜੋ ਵੀ ਹੈਆ ਇਹ ਸਾਰਾ ਮੈਂ ਆਪਣੀਆਂ ਫੋਟੋਆਂ ਵਿੱਚ ਲਵਾਂਗੀ ਤਾਂ ਜੋ ਮੈਂ ਆਪਣੇ ਭਾਰਤ ਨੂੰ ਦੂਰ ਦੂਰ ਤੱਕ ਦਿਖਾ ਸਕਾਂ